ਮੈਂ ਰਾਮਦਾਸ ਪਿੰਡ ਨਵਾਂ ਗੁਗ੍ਰਾਹ ਅਤੇ ਡਾਕਖਾਨਾ ਸੁੰਦਰਚਕ ਸੁ ਸੁਜਾਨਪੁਰ ਅਤੇ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਮੇਰੀ ਬੇਟੀ ਨੇ ਮੈਨੂੰ ਦੱਸਿਆ ਕਿ ਪਾਪਾ ਅੱਜ ਕੱਲ੍ਹ ਔਨਲਾਈਨ ਸ਼ੈ ਸ਼ਾਪਿੰਗ ਸ਼ੁਰੂ ਹੋ ਹੋ ਗਈ ਹੈ ਅਤੇ ਤਾਂ ਮੇਰੇ ਮਨ ਵਿੱਚ ਵੀ ਇੱਛਾ ਜਾਗੀ ਕਿ ਮੈਂ ਵੀ ਕੋਈ ਸ਼ੂਜ ਜਿਹੜਾ ਉਹ ਇੱਕ ਜੋੜਾ ਲੈ ਲਵਾਂ ਅਤੇ ਮੈਂ ਆਨਲਾਈਨ ਸਰਚ ਕੀਤਾ ਤ ਤੁਹਾਡੀ ਕੰਪਨੀ ਦੇ ਬਾਰੇ ਮੈਨੂੰ ਲੱਗਿਆ ਪਤਾ ਵੀ ਤੁਹਾਡੀ ਵੂਡਲੈਂਡ ਕੰਪਨੀ ਦੇ ਸ਼ੂਜ ਬਹੁਤ ਵਧੀਆ ਹਨ ਕਿਉਂਕਿ ਮੇਰੇ ਗੁਆਂਢ ਤੋਂ ਵੀ ਇੱਕ ਦੋਸਤ ਹੈ ਮੇਰਾ ਉਹਨੇ ਵੀ ਵੂਡਲੈਂਡ ਦੇ ਬੂਟ ਜਿਹੜੇ ਆ ਉਹ ਲਏ ਸਨ ਕਿ ਬ ਜਿਹੜੇ ਦੇਖਣ 'ਚ ਬੜੇ ਚੰਗੇ ਲੱਗੇ ਸਨ ਇਸ ਕਰਕੇ ਮੈਨੂੰ ਤੁਹਾਡੀ ਕੰਪਨੀ ਦੇ ਬੂਟ ਜਿਹੜੇ ਆ ਉਹਨੇ ਮੋਹ ਲਿਆ ਅਤੇ ਮੈਂ ਉਹਨਾਂ ਦਾ ਆਡਰ ਕਰਨਾ ਚਾਹਿਆ ਬੇਟੀ ਨੇ ਮੈਨੂੰ ਵੈਬਸਾਈਟ ਦਾ ਨੰਬਰ ਦਿੱਤਾ ਅਤੇ ਮੈਂ ਆਡਰ ਕਰ ਦਿੱਤਾ ਜਦੋਂ ਮੈਂ ਆਡਰ ਕੀਤਾ ਤਾਂ ਕੁਝ ਦਿਨਾਂ ਬਾਅਦ ਉਹ ਆਡਰ ਮੇਰੇ ਘਰ ਪੁੱਜ ਗਿਆ ਮੈਂ ਜਦੋਂ ਉਸ ਬਕਸੇ ਨੂੰ ਖੋਲ੍ਹਿਆ ਤਾਂ ਉਸ ਵਿੱਚ ਮੈਂ ਜੋ ਚੀਜ਼ ਮੰਗਵਾਈ ਸੀ ਉਹ ਉਹੀ ਚੀਜ਼ ਸੀ ਉਹ ਵੀ ਇੰਨੇ ਵਧੀਆ ਅਤੇ ਇੰਨੇ ਕੰਫਰਟੇਬਲ ਬੂਟ ਸਨ ਕਿ ਮੈਂ ਬੜੇ ਹੀ ਉਹ ਮੈਂ ਚੰ ਪਸੰਦ ਕੀਤੇ ਅਤੇ ਮੈਂ ਕਦੀ ਜ਼ਿੰਦਗੀ ਵਿੱਚ ਇਹੋ ਜਿਹੇ ਬੂਟ ਪਹਿਲਾਂ ਨਹੀਂ ਦੇਖੇ ਸਨ ਮੈਂ ਉਹਨਾਂ ਦੀ ਤਾਰੀਫ਼ ਕਰਦਾ ਕਰਦਾ ਥੱਕਦਾ ਨਹੀਂ ਹਾਂ ਜਦੋਂ ਮੈਂ ਆਪਣੇ ਦੋਸਤ ਨੂੰ ਉਹਨਾਂ ਬਾਰੇ ਦੱਸਿਆ ਤਾਂ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਇਹ ਬੂਟ ਬੜੇ ਚੰਗੇ ਹਨ ਅਤੇ ਮੈਂ ਉਹ ਸੂਜ ਜਿੱਥੇ ਵੀ ਪਾ ਕੇ ਜਾਂਦਾ ਹਾਂ ਲੋਕ ਉਸ ਦੀ ਤਾਰੀਫ਼ ਕਰਦੇ ਥੱਕਦੇ ਨਹੀਂ ਅਤੇ ਮੈਨੂੰ ਵਾਰ ਵਾਰ ਪੁੱਛਦੇ ਨੇ ਇਹ ਕਿਸ ਕੰਪਨੀ ਤੋਂ ਅਤੇ ਕਿੱਥੋਂ ਮੰਗਵਾਏ ਨੇ ਬੂਟ ਅਸੀਂ ਵੀ ਖਰੀਦਣੇ ਹਨ ਮੈਂ ਉਹ ਸੂਜ ਲੋਕਾਂ ਨੂੰ ਉਹਦੀ ਪ੍ਰਸ਼ੰਸਾ ਬਾਰੇ ਦੱਸਦਾ ਹਾਂ ਕਿ ਉਹ ਬਹੁਤ ਹੀ ਵਧੀਆ ਹਨ ਅਤੇ ਉਹ ਵੀ ਮੰਗਾਉਣ ਜੇ ਤਾਂ ਉਹਨਾਂ ਦਾ ਜੀਅ ਕਰਦਾ ਤਾਂ ਮੰਗਵਾ ਲੈਣ ਉਹ ਵੀ ਮੈਨੂੰ ਵਾਰ ਵਾਰ ਲੋਕ ਪੁੱਛਦੇ ਹਨ ਕਿ ਇਹ ਬੂਟ ਕਿੱਥੋਂ ਮੰਗਵਾਏ ਹਨ ਇਸ ਤਰ੍ਹਾਂ ਮੈਂ ਕਹਿ ਸਕਦਾ ਹਾਂ ਕੁਝ ਕੁਝ ਚੀਜ਼ਾਂ ਕੰਪਨੀ ਅਜਿਹੀਆ ਬਣਾਉਂਦੀ ਹੈ ਅਤੇ ਭੇਜਦੀ ਹੈ ਜੋ ਲੋਕਾਂ ਦੇ ਮਨ ਨੂੰ ਮੋਹ ਲੈਂਦੇ ਹਨ ਅਤੇ ਉਹਨਾਂ ਦੀ ਤਾਰੀਫ਼ ਜਿੰਨੀ ਵੀ ਕੀਤੀ ਜਾਏ ਬੜੀ ਘੱਟ ਹੈ ਧੰਨਵਾਦ